ਹਜੇ ਕੱਲ੍ਹ ਮੈਂ ਇੱਕ ਟ੍ਰੇਨ ਦੀ ਟਿਕਟ ਬੁੱਕ ਕੀਤੀ ਸੀ ਪਰ ਅੱਜ ਅਚਾਨਕ ਹੀ ਮੈਨੂੰ ਇਹ ਆਪਣਾ ਜੋ ਜਾਣ ਦਾ ਪ੍ਰੋਗਰਾਮ ਹੈ ਕੈਂਸਲ ਕਰਨਾ ਪੈ ਰਿਹਾ ਜੀ ਅਤੇ ਇਸ ਕਰਕੇ ਮੈਂ ਚਾਹੁੰਦਾ ਕਿ ਜਿਹੜੀ ਮੇਰੀ ਇਹ ਟਰੇਨ ਦੀ ਟਿਕਟ ਹੈ ਇਹਨੂੰ ਰੱਦ ਕਰ ਦਿੱਤਾ ਜਾਵੇ ਮੇਰਾ ਜਿਹੜਾ ਪੀ ਐਨ ਆਰ ਨੰਬਰ ਹੈ ਜੀ ਉਹ ਹੈਗਾ ਇੱਕ ਸੌ ਪੈਂਤੀ ਅਤੇ ਮੇਰੀ ਆਈ ਡੀ ਹੈਗੀ ਹੈ ਜੀਰੋ ਜੀਰੋ ਸੱਤ ਸੌ ਅਠਾਹਟ ਅਤੇ ਮੇਰਾ ਪਾਸਵਰਡ ਹੈਗਾ ਆਰ ਏ ਐਮ ਏ ਐਨ ਐਟ ਵਨ ਟੂ ਥਰੀ ਮੈਂ ਆਪ ਜੀ ਨੂੰ ਅਸੁਵਿਧਾ ਲਈ ਆਪ ਜੀ ਤੋਂ ਮਾਫ਼ੀ ਮੰਗਦਾ ਹਾਂ ਪਰ ਅਚਾਨਕ ਹੀ ਇੱਕ ਬਹੁਤ ਹੀ ਜ਼ਰੂਰੀ ਰੁਝੇਵਾਂ ਆਉਣ ਕਰਕੇ ਮੈਨੂੰ ਆਪਣੀ ਇਹ ਜਿਹੜੀ ਯਾਤਰਾ ਹੈ ਉਹ ਛੱਡਣੀ ਪੈ ਰਹੀ ਹੈ ਅਤੇ ਮੈਂ ਚਾਹੁੰਦਾ ਕਿ ਤੁਸੀਂ ਮੇਰੀ ਬੇਨਤੀ ਹੈ ਕਿ ਟਿਕਟ ਨੂੰ ਰੱਦ ਕਰ ਦਿਓ ਅਤੇ ਜੋ ਨਿਯਮ ਅਨੁਸਾਰ ਜਿਹੜੇ ਮੇਰੇ ਪੈਸੇ ਨੇ ਉਹ ਤੁਸੀਂ ਮੈਨੂੰ ਵਾਪਿਸ ਕਰ ਦਿਓ ਤਾਂ ਤੁਹਾਡਾ ਬੜਾ ਧੰਨਵਾਦ ਹੋਵੇਗਾ ਅਤੇ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਜਦੋਂ ਮੈਨੂੰ ਜ਼ਰੂਰਤ ਹੋਊ ਤਾਂ ਮੈਂ ਦੁਬਾਰਾ ਤੋਂ ਤੁਹਾਡੇ ਰਾਹੀਂ ਆਪਣੀ ਟਿਕਟ ਬੁੱਕ ਕਰਵਾ ਲਵਾਂਗਾ ਸੋ ਇਸ ਸਮੇਂ ਮੈਂ ਨਹੀਂ ਜਾ ਸਕਦਾ ਕਿਰਪਾ ਕਰਕੇ ਜਿਹੜੀ ਮੇਰੀ ਟਿਕਟ ਹੈ ਇਹਨੂੰ ਕੈਂਸਲ ਕਰ ਦਿਓ ਆਪ ਦਾ ਬੜਾ ਧੰਨਵਾਦ ਹੋਵੇਗਾ ਜੀ ਥੈਂਕ ਯੂ